ਜਦੋਂ ਘਰ ਵਿੱਚ ਬਹੁਤ ਸਾਰੇ ਪਰਾਹੁਣੇ ਆ ਜਾਣ ਤਾਂ ਬਹੁਤ ਸਾਰੀ ਰੋਟੀ ਜਾਂ ਖਾਣਾ ਬਣਾਉਣਾ ਪੈਂਦਾ ਹੈ ਜਿਸ ਲਈ ਸਾਨੂੰ ਵੱਡੀਆਂ ਵੱਡੀਆਂ ਕੜਾਹੀਆਂ ਅਤੇ ਪਤੀਲਿਆਂ ਦੀ ਵਰਤੋਂ ਕਰਨੀ ਪੈਂਦੀ ਹੈ ਫੁਲਕੇ ਲਾਹੁਣ ਲਈ ਸਾਨੂੰ ਦੋ ਗੈਸਾਂ ਦੀ ਲੋੜ ਪੈਂਦੀ ਹੈ ਅਤੇ ਦੋ ਤਿੰਨ ਜਣਿਆਂ ਨੂੰ ਨਾਲ ਲੱਗਣਾ ਪੈਂਦਾ ਹੈ ਕੰਮ ਕਰਨ ਲਈ ਪਰਾਹੁਣਿਆਂ ਲਈ ਖਾਣਾ ਬਣਾਉਣ ਲਈ ਸਾਰਿਆਂ ਨੂੰ ਇਕੱਠੇ ਲੱਗਣਾ ਪੈਂਦਾ ਹੈ ਇਹ ਫਿਰ ਜਲਦੀ ਜਲਦੀ ਵਿੱਚ ਰੋਟੀ ਬਣਾਉਣੀ ਪੈਂਦੀ ਹੈ ਇੱਕ ਚੁੱਲ੍ਹੇ ਉੱਤੇ ਪਨੀਰ ਦੀ ਸਬਜ਼ੀ ਅਤੇ ਦੂਜੇ ਦੇ ਉੱਤੇ ਫੁਲਕੇ ਲਾਹੇ ਜਾਂਦੇ ਹਨ ਪਹਿਲੇ ਆਟਾ ਗੁੰਨ੍ਹ ਕੇ ਫਿਰ ਫੁਲਕਿਆਂ ਨੂੰ ਲਾਹਿਆ ਜਾਂਦਾ ਹੈ ਅਤੇ ਇੱਕ ਜਣਾ ਫੁਲਕੇ ਲਾਹੁੰਦਾ ਹੈ ਅਤੇ ਦੂਜਾ ਜਣਾ ਪਨੀਰ ਦੀ ਸਬਜ਼ੀ ਬਣਾਉਂਦਾ ਹੈ ਪਨੀਰ ਦੀ ਸਬਜ਼ੀ ਬਣਾਉਣ ਲਈ ਜਲਦੀ ਜਲਦੀ ਪਿਆਜ਼ ਕੱਟ ਕੇ ਉਸਨੂੰ ਕੜਾਹੀ ਵਿੱਚ ਪਾ ਦਿੱਤਾ ਜਾਂਦਾ ਹੈ ਤੇਲ ਵਿੱਚ ਪਾ ਕੇ ਉਸਨੂੰ ਚੰਗੀ ਤਰ੍ਹਾਂ ਭੁੰਨ ਕੇ ਉਸ ਵਿੱਚ ਮਸਾਲੇ ਪਾ ਦਿੱਤੇ ਜਾਂਦੇ ਹਨ ਅਤੇ ਫਿਰ ਪਨੀਰ ਨੂੰ ਫਰਾਈ ਕਰਕੇ ਉਸ ਵਿੱਚ ਪਾ ਦਿੱਤਾ ਜਾਂਦਾ ਹੈ ਤਾਂ ਜੋ ਪਨੀਰ ਬਣ ਜਾਵੇ ਅਤੇ ਫਿਰ ਪਨੀਰ ਨਾਲ ਫੁਲਕੇ ਲਾਹ ਦਿੱਤੇ ਜਾਂਦੇ ਹਨ ਇੱਕ ਅੱਧੀ ਮਿੱਠੀ ਸਬਜ਼ੀ ਜਾਂ ਮਿੱਠੀ ਖੀਰ ਬਣਾ ਦਿੱਤੀ ਜਾਂਦੀ ਹੈ ਤਾਂ ਜੋ ਨਮਕੀਨ ਖਾਣ ਤੋਂ ਬਾਅਦ ਪਰਾਹੁਣੇ ਮਿੱਠਾ ਖਾ ਲੈਣ ਤਾਂ ਨੀਂਦ ਸੌਖੀ ਪੈ ਜਾਂਦੀ ਹੈ ਅਤੇ ਇਸ ਤਰ੍ਹਾਂ ਜਲਦੀ ਜਲਦੀ ਖਾਣਾ ਬਣਾਉਣ ਲਈ ਦੋ ਜਣਿਆਂ ਨੂੰ ਜਾਂ ਤਿੰਨ ਜਣਿਆਂ ਨੂੰ ਇਕੱਠੇ ਲੱਗਣਾ ਪੈਂਦਾ ਹੈ ਅਤੇ ਜਲਦੀ ਖਾਣਾ ਬਣ ਜਾਂਦਾ ਹੈ ਧੰਨਵਾਦ